ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਓਂਕਾਰ ਜੂਐਲਰ ਤੋਂ ਗੱਲ ਕਰ ਰਹੇ ਹਾਂ ਜੀ ਸਤਿ ਸ਼੍ਰੀ ਅਕਾਲ ਭਾਅ ਜੀ ਬਣਵਾਉਣਾ ਹੈ ਜੀ ਹਾਂਜੀ ਬਣਾ ਦਿਆਂਗੇ ਜੀ ਬਾਹਰ ਲਿਜਾਉਣਾ ਜੀ ਠੀਕ ਹੈ ਹਾਂਜੀ ਹਾਂ ਹਾਂ ਤੁਹਾਨੂੰ ਜੋ ਵੀ ਤੁਸੀਂ ਐਟਮ ਸਾਡੇ ਤੋਂ ਪਰਚੇਜ਼ ਕਰੋਂਗੇ ਖਰੀਦੋਂਗੇ ਉਹਦੀ ਜਿੰਨਾ ਵੇਟ ਹੋਏਗਾ ਐਕਚੁਅਲ ਐਕਚੁਅਲ ਵੇਟ ਦੇ ਅਕੋਰਡਿੰਗ ਪ੍ਰੋਪਰ ਜੀ ਐਸ ਟੀ ਹੋਲਮਾਰਕ ਔਰ ਪਿੰਨ ਨੰਬਰ ਟੈਨ ਨੰਬਰ ਵਗੈਰਾ ਜੋ ਸਾਡਾ ਲੋਗੋ ਹੈ ਪਲੱਸ ਲੈਟਰ ਹੈੱਡ ਜਿਹੜੀ ਹੈਗੀ ਹੈ ਬਿਲਿੰਗ ਲੈਟਰ ਪੈਡ ਜਿਹੜੀ ਹੈ ਉਹ ਤੁਹਾਨੂੰ ਐਕਚੁਅਲ ਜਿਹੜਾ ਬਣਦਾ ਬਿੱਲ ਹੈ ਉਹ ਤੁਹਾਨੂੰ ਦੇਵਾਂਗੇ ਤਾਂ ਕਿ ਤੁਹਾਨੂੰ 'ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਅਤੇ ਫਿਰ ਵੀ ਉਹਦੇ ਰਿਗਾਰਡਿੰਗ ਕੋਈ ਸਮੱਸਿਆ ਆਉਂਦੀ ਹੈ ਤਾਂ ਸਾਡਾ ਨੰਬਰ ਜਿਹੜਾ ਉਹ ਕੀ ਲੈਟਰ ਸਾਡੀ ਜਿਹੜੀ ਬਿੱਲ ਬੁਕ ਹੈ ਉਹ ਜਿਹੜਾ ਬਿੱਲ ਤੁਹਾਨੂੰ ਦੇਵਾਂਗੇ ਉਹਦੇ ਉੱਤੇ ਮੈਂਸ਼ਨ ਹੈ ਅਤੇ ਤੁਸੀਂ ਉਸ 'ਤੇ ਆਕੇ ਨਹੀਂ ਨਹੀਂ ਉਹਦੇ ਲਈ ਅਸੀਂ ਵਚਨਬੱਧ ਰਹਾਂਗੇ ਕਿਉਂਕਿ ਅਸੀਂ ਜਿਹੜਾ ਤੁਹਾਨੂੰ ਬਿੱਲ ਦੇਵਾਂਗੇ ਉਹ ਪੱਕਾ ਬਿੱਲ ਹੋਵੇਗਾ ਨਾ ਕਿਸੇ ਤਰ੍ਹਾਂ ਦੀ ਉਹਦੇ ਵਿੱਚ ਨਹੀਂ ਨਹੀਂ ਜੀ ਐੱਸ ਟੀ ਵਿੱਦ ਜੀ ਐੱਸ ਟੀ ਕੰਪਲੀਟ ਕੰਪਲੀਟ ਉਸ ਤਰ੍ਹਾਂ ਦਾ ਤੁਹਾਨੂੰ ਬਿੱਲ ਦੇਵਾਂਗੇ ਨਹੀਂ ਨਹੀਂ ਕਿਸੇ ਤਰ੍ਹਾਂ ਦੀ ਤੁਹਾਨੂੰ ਦਿੱਕਤ ਨਹੀਂ ਆਉਣੀ ਇਸ 'ਚ ਹਾਂ ਕੋਈ ਦਿੱਕਤ ਜਾਂ ਪਰੇਸ਼ਾਨੀ ਤੁਹਾਨੂੰ ਇਹਦੇ ਵਿੱਚ ਨਹੀਂ ਆਉਣੀ ਜੀ ਹਾਂਜੀ ਨਹੀਂ ਨਹੀਂ ਪੱਕਾ ਬਿੱਲ ਦੇਵਾਂਗੇ ਤੁਹਾਨੂੰ ਜੀ ਕੋਈ ਸਮੱਸਿਆ ਤੁਹਾਨੂੰ ਆਉਣੀ ਨਹੀਂ ਜੀ ਉਸ ਤੋਂ ਇਲਾਵਾ ਜੇ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਸਾਡਾ ਜਿਹੜਾ ਨੰਬਰ ਵਗੈਰਾ ਹੈਗਾ ਉਹਦੇ 'ਤੇ ਮੈਂਸ਼ਨ ਹੈਗਾ ਹੀ ਹੈ ਤੁਹਾਡੇ ਕੋਲੇ ਹਾਂਜੀ ਹਾਂਜੀ

ਉਹਦੀ ਫਿਨਿਸ਼ਿੰਗ ਵਗੈਰਾ ਉਹਦੀ ਕੁਆਲਿਟੀ ਅਤੇ ਉਹਦੇ ਜਿਹੜੇ ਡਿਜ਼ਾਇਨਸ ਹੈਗੇ ਆ ਜੇ ਤੁਹਾਨੂੰ ਫਿਰ ਵੀ ਉਹਦੇ ਵਿੱਚ ਕੋਈ ਦਿੱਕਤ ਜਾਂ ਚੇਂਜਿਸ ਲੱਗਦੀ ਹੈ ਤਾਂ ਅਸੀਂ ਤੁਹਾਨੂੰ ਉਹ ਵੀ ਚੇਂਜ ਵਗੈਰਾ ਕਰਾ ਦਿਆਂਗੇ ਜੀ ਨਹੀਂ ਉਹਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਏਗੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਹਾਂ ਨਹੀਂ ਨਹੀਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂਜੀ ਓਕੇ ਓਕੇ ਜੀ ਓਕੇ ਓਕੇ